ਹੈਲੋ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਤੁਹਾਡੇ ਇੰਸਟਾਗਰਾਮ 'ਤੇ ਨੇ ਅਸੀਂ ਬੂਟਾਂ ਲਈ ਦੇਖੇ ਸੀਗੇ ਹਾਂਜੀ ਜੇ ਬੂਟ ਤੁਹਾਡੇ ਵਧੀਆ ਪਰ ਰੇਟ ਜ਼ਿਆਦਾ ਲੱਗੇ ਬਾਈ ਅੱਛਾ ਅੱਛਾ ਜੀ ਠੀਕ ਹੈ ਜੀ ਠੀਕ ਹੈ ਵੀਰ ਜੀ ਠੀਕ ਹੈ ਵੀਰ ਜੀ ਠੀਕ ਹੈ ਵੀਰ ਜੀ ਅੱਛਾ ਜੀ ਵੀਰ ਜੀ ਹੋਰ ਕਈ ਬ੍ਰਾਂਡ ਹੋਣਗੇ ਤੁਹਾਡੇ ਕੋਲ ਬੂਟਾਂ ਦੇ ਅਤੇ ਜਿਹੜੇ ਹੁੰਦੇ ਸਾਰੇ ਓਰਿਜਿਨਲ ਹੀ ਹੁੰਦੇ ਬ੍ਰਾਂਡ ਆਪਣੇ ਕੋਲ

ਅੱਛਾ ਜੀ ਠੀਕ ਹੈ ਜੀ ਅੱਛਾ ਜੀ ਅੱਛਾ ਅੱਛਾ ਜੀ ਹੋਰ ਡਿਸਕਾਊਂਟ ਵੀਰ ਕੋਈ ਬੂਟਾਂ 'ਤੇ ਘੱਟ ਤੋਂ ਘੱਟ

ਠੀਕ ਹੈ ਵੀਰ ਜੀ ਹਾਂ ਸਟਾਰਟਿੰਗ ਵੀ ਪੰਜ ਸੌ ਤੋਂ ਸਟਾਰਟਿੰਗ ਕੋਈ ਸੱਤ ਸੌ ਤੋਂ ਬੂਟਾਂ ਦੀ ਸਟਾਰਟਿੰਗ ਵੀਰੇ ਫਿਰ ਪੰਜ ਸੌ ਤੋਂ ਸਟਾਰਟ ਹੋਊਗੀ ਬੂਟਾਂ ਦੀ ਵੀ ਬਾਕੀ ਜਿੰਨੇ ਮਹਿੰਗੇ ਲੈਣੇ ਠੀਕ ਹੈ ਵੀਰ ਜੀ ਧੰਨਵਾਦ ਜੀ